ਵੇਹੜੇ ਜਾਂ ਬਾਗ ਦੇ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ ਸੁਝਾਵ ਹੋ ਸਕਦੇ ਨੇ ਜਿਵੇਂ ਅਸੀਂ ਉਹਨਾਂ ਲਈ ਪਾਣੀ ਰੱਖ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਜਿਹੜਾ ਹੈਗਾ ਪਾਣੀ ਦੀ ਇੰਨੀ ਕਿੱਲਤ ਹੋ ਚੁੱਕੀ ਹੈ ਅਤੇ ਗਰਮੀਆਂ ਦੇ ਵਿੱਚ ਇਵੈਪੋਰੇਸ਼ਨ ਬਹੁਤ ਜ਼ਿਆਦਾ ਲੈਵਲ 'ਤੇ ਹੁੰਦੀ ਹੈ ਜਿਹਦੇ ਕਰਕੇ ਪੰਛੀਆਂ ਨੂੰ ਕਈ ਵਾਰੀ ਪਾਣੀ ਤੋਂ ਬਿਨਾਂ ਹੀ ਪਿਆਸੇ ਉਹਨਾਂ ਨੂੰ ਇੱਧਰ ਉੱਧਰ ਭਟਕਣਾ ਪੈਂਦਾ ਜਿਹਦੇ ਕਰਕੇ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਅਤੇ ਅਸੀਂ ਪਾਣੀ ਰੱਖ ਸਕਦੇ ਹਾਂ ਉਹਨਾਂ ਲਈ ਉਹਨਾਂ ਲਈ ਖਾਣਾ ਵੀ ਰੱਖਿਆ ਜਾ ਸਕਦਾ ਹੈ ਅਤੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਫੁੱਲ ਵੀ ਉਹ ਉਗਾਏ ਜਾ ਸਕਦੇ ਨੇ ਤਾਂ ਕਿ ਉਹ ਜਿਹੜੇ ਹੈਗੇ ਆ ਆਪਣੇ ਬਾਗ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਆਕਰਸ਼ਿਤ ਹੋਣ ਅਤੇ ਕਈ ਤਰ੍ਹਾਂ ਦੇ ਦਰਖਤ ਵੀ ਜਿਹੜੇ ਹੈਗੇ ਲਾਏ ਜਾ ਸਕਦੇ ਨੇ ਤਾਂ ਕਿ ਉਹਨਾਂ ਦੇ ਉੱਪਰੋਂ ਆਲ੍ਹਣਾ ਬਣਾ ਕੇ ਰਹਿ ਸਕਣ ਅਤੇ ਅਸੀਂ ਜਿਹੜਾ ਆਪਣੇ ਘਰ ਦੇ ਵਿੱਚ ਮੈਂ ਇਹ ਟਰਾਈ ਕਰਦੀ ਹਾਂ ਮੇਰੀ ਛੱਤ ਜਿਹੜੀ ਘਰ ਦੀ ਛੱਤ ਹੈ ਉਹਦੇ ਉੱਪਰ ਮੈਂ ਅਨਾਜ ਅਤੇ ਪਾਣੀ ਰੱਖਦੀ ਹਾਂ ਤਾਂ ਕਿ ਜਿਹੜੇ ਪੰਛੀ ਹੈ ਉਹ ਆਉਣ ਆਪਣਾ ਖਾਣਾ ਖਾਣ ਅਤੇ ਪਾਣੀ ਪੀਣ ਅਤੇ ਜਦੋਂ ਵੀ ਕਦੇ ਉਹਨਾਂ ਨੂੰ ਲੱਗੇ ਕਿ ਸਾਨੂੰ ਪਾਣੀ ਦੀ ਅਨਾਜ ਦੀ ਜ਼ਰੂਰਤ ਏ ਪਰ ਉਹਨਾਂ ਨੂੰ ਨਹੀਂ ਲੱਭ ਰਿਹਾ ਤਾਂ ਉੱਥੇ ਆਉਣ ਤਾਂ ਕਿ ਅਤੇ ਆਪਣਾ ਜਿਹੜਾ ਹੈਗਾ ਪੇਟ ਭਰ ਭੋਜਨ ਕਰਨ ਇਹਦੇ ਨਾਲ ਮੈਨੂੰ ਲੱਗਦਾ ਕਿ ਸਾਨੂੰ ਪੁੰਨ ਮਿਲਦਾ ਕਿਉਂਕਿ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਨ ਪੰਛੀ ਹੁੰਦੇ ਨੇ ਉਹ ਆਪਣੀ ਜਿਹੜੀ ਹੈਗੀ ਹੈ ਆਪਣੇ ਜੀਵਨ ਦੇ ਲਈ ਬਹੁਤ ਹੀ ਜ਼ਰੂਰੀ ਨੇ ਪੰਛੀ ਹੋਣ ਚਾਹੇ ਜਾਨਵਰ ਹੋਣ ਆਪਣੇ ਲਈ ਬਹੁਤ ਜ਼ਰੂਰੀ ਹੈ ਦੈਟਸ ਵਾਈ ਮੈਨੂੰ ਲੱਗਦਾ ਕਿ ਉੱਥੇ ਅਨਾਜ ਅਤੇ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਹ ਮੈਂ ਰੋਜ਼ ਹੀ ਕਰਦੀ ਹਾਂ ਅਤੇ ਮੇਰੇ ਜਿਹੜੇ ਘਰ ਦੇ ਨੇ ਉਹ ਵੀ ਸਾਰੇ ਜਿਹੜਾ ਹੈਗਾ ਹਰ ਇੱਕ ਮੈਂਬਰ ਮੇਰੇ ਫੈਮਿਲੀ ਦਾ ਹਰ ਇੱਕ ਮੈਂਬਰ ਇੱਦਾਂ ਦੇ ਜਿਹੜੇ ਹੈਗੇ ਕੰਮ ਕਰਦੇ ਰਹਿੰਦੇ ਨੇ ਅਸੀਂ ਟਰਾਈ ਕਰਦੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਾਈਏ ਅਤੇ ਸਾਡੇ ਵਿਹੜੇ ਦੇ ਵਿੱਚ ਕਈ ਤਰ੍ਹਾਂ ਦੇ ਦਰੱਖਤ ਹੈਗੇ ਨੇ ਸਾਡੇ ਜਿਹੜਾ ਹੈਗਾ ਇੱਕ ਬਾ ਬਾਗ ਵੀ ਬਣਿਆ ਹੋਇਆ ਜਿਹਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਨੇ ਅਤੇ ਕਈ ਵਾਰ ਅਸੀਂ ਜਿਹੜੇ ਹੈਗੇ ਪੰਛੀ ਦੇਖਣ ਨੂੰ ਮਿਲਦੇ ਨੇ ਉੱਥੇ ਅਤੇ ਉੱਥੇ ਆਲ੍ਹਣਾ ਬਣਾ ਕੇ ਵੀ ਰਹਿੰਦੇ ਨੇ